ਬੂਟੇ ਲਗਾਉਣ ਦੀ ਜੇ ਗੱਲ ਕਰੀਏ ਤਾਂ ਅਸੀਂ ਕੋਈ ਕਿਸਾਨ ਤਾਂ ਹੈ ਨਹੀਂ ਹਾਂ ਘਰਾਂ ਦੇ ਵਿੱਚ ਅਸੀਂ ਗਮਲਿਆਂ ਦੇ ਵਿੱਚ ਕੁਛ ਬੂਟੇ ਲਾ ਲੈਂਦੇ ਹਾਂ ਆਪਣੀ ਲੋੜ ਦੇ ਮੁਤਾਬਿਕ ਜਿਵੇਂ ਕਿ ਕੁਛ ਸਬਜ਼ੀਆਂ ਦੇ ਬੂਟੇ ਗਰਮੀਆਂ ਨੂੰ ਜਿਹੜੇ ਹੁੰਦੇ ਆ ਕਿ ਉਹ ਪਤਾ ਹੁੰਦਾ ਸਾਨੂੰ ਆਪਾਂ ਬੈਂਗਣਾ ਆਮ ਗਰਮੀਆਂ 'ਚ ਬੈਂਗਣ ਦੇ ਬੂਟੇ ਲਾ ਲਏ ਟਮਾਟਰ ਦੇ ਬੂਟੇ ਲਾ ਲਈ ਦੇ ਆ ਅਤੇ ਸਰਦੀਆਂ ਦੇ ਵਿੱਚ ਫਿਰ ਸ ਸਰਦੀਆਂ ਦੇ ਮੌਸਮ ਦੇ ਫਿਰ ਸਰਦੀਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਸਰਦੀਆਂ ਨੂੰ ਆਪਾਂ ਕੀ ਕੀ ਲਗਾਉਣਾ ਹੈਗਾ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਪਾਲਕ ਹੋ ਗਿਆ ਜੀ ਸਾਗ ਹੋ ਗਿਆ ਮੇਥੀ ਹੋ ਗਈ ਇਹੋ ਜਿਹੇ ਜਿਹੜੇ ਬੂਟੇ ਆ ਸਾਨੂੰ ਆਪਾਂ ਨੂੰ ਸਰਦੀਆਂ ਵਿੱਚ ਲੱਗਣੇ ਹੁੰਦੇ ਆ ਬਾਕੀ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਰਸਾਇਨਿਕ ਕੀਟਨਾਸ਼ਕ ਹੈ ਇਹ ਮਿੱਟੀ ਨੂੰ ਤਾਂ ਖਰਾਬ ਕਰ ਕਰਦੇ ਹੀ ਨੇ ਕਿਉਂਕਿ ਅਸਰ ਇਹਨਾਂ ਦਾ ਮਿੱਟੀ ਦੇ 'ਤੇ ਹੁ ਬੁਰਾ ਅਸਰ ਪੈਂਦਾ ਹੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਤੱਤ ਹੁੰਦੇ ਆ ਜਿਹੜੇ ਜੀਵ ਲੋੜੀਂਦੇ ਹੁੰਦੇ ਆ ਮਿੱਟੀ ਦੇ ਲਈ ਜਾਂ ਬਾਗਵਾਨੀ ਦੇ ਲਈ ਉਹਨੂੰ ਇਹ ਖਤਮ ਕਰਦੇ ਇਸ ਲਈ ਇਹ ਜਿਹੜੇ ਸਮਝ ਲਓ ਵੀ ਇਹਦੀ ਮਿੱਟੀ ਦੀ ਸ਼ਮਤਾ ਜਿਹੜੀ ਘਟਾਉਂਦੇ ਨੇ